ਹੈਲੋ ਹਾਂਜੀ ਭਾਅ ਜੀ ਤੁਸੀਂ ਸ਼ਰਿਆਂਸ਼ ਦੇ ਪੇਰੈਂਟ ਬੋਲਦੇ ਪਏ ਹੋ ਭਾਅ ਜੀ ਤੁਹਾਡੇ ਨਾ ਭਾਅ ਜੀ ਮੈਂ ਕੀ ਸ਼ਰਿਆਂਸ਼ ਦੇ ਸਕੂਲ ਦਾ ਟੀਚਰ ਬੋਲਦਾ ਪਿਆ ਕਲਾਸ ਟੀਚਰ ਹਾਂ ਉਹਦਾ ਅਸੀਂ ਨਾ ਇੱਕ ਟ੍ਰਿੱਪ ਪਲੈਨ ਕੀਤੀ ਹੈ ਵੰਡਰਲੈਂਡ ਜਾਣ ਵਾਸਤੇ ਅਤੇ ਉਹਦੇ ਬਾਰੇ ਪੁੱਛਣਾ ਸੀਗਾ ਕਿ ਤੁਹਾਡੀ ਪਰਮਿਸ਼ਨ ਹੈਗੀ ਤੁਹਾਡੀ ਤੁਹਾਡੇ ਜਵਾਕ ਨੂੰ ਲੈ ਜਾਣ ਵਾਸਤੇ ਸਾਨੂੰ ਹਾਂਜੀ ਭਾਅ ਜੀ ਉਹ ਉਹਦਾ ਨੀ ਅਸੀਂ ਸਿਰਫ ਐਨ ਐਂਟਰ ਫੀਸ ਲੈਣੀ ਆ ਐਂਟਰੀ ਫੀਸ ਵੰਡਰਲੈਂਡ ਦੀ ਚੌਦਾਂ ਸੌ ਰੁਪਏ ਹੈਗੀ ਅਤੇ ਉ ਉਹਦਾ ਹੀ ਖਰਚਾ ਵਾ ਹੋਰ ਕੋਈ ਖਰਚਾ ਨਹੀਂ ਹੈਗਾ ਜੀ ਪਰਸੋਂ ਜਾਣੀ ਆ ਸਵੇਰੇ ਸੱਤ ਵਜੇ ਤੱਕ ਨਿਕਲਣਗੇ ਸ਼ਾਮੀ ਅੱ ਸੱਤ ਅੱਠ ਵਜੇ ਤੱਕ ਪਹੁੰਚੇਗਾ ਬੱਚਾ ਹਾਂਜੀ ਸਰ ਬੱਚੇ ਰਾਂਹੀ ਭੇਜ ਦਿਓ ਭਾਅ ਜੀ ਕੋਈ ਨਹੀਂ ਉਹੀ ਫੜਾ ਦਊਗਾ ਮੈਨੂੂੰ ਓਕੇ ਭਾਅ ਜੀ